ਸੀਨੀਅਰ ਅਤੇ ਸੇਵਾ ਕੇਂਦਰ ਦੇ ਅਧਿਕਾਰੀ ਸਾਡੇ ਰਿਸ਼ਤੇਦਾਰੀ ਵਿੱਚ ਬਜ਼ੁਰਗ ਦੀ ਡੈੱਥ ਹੋ ਚੁੱਕੀ ਹੈ ਅਤੇ ਕਿਰਪਾ ਕਰਕੇ ਉਹਨਾਂ ਦਾ ਰਜਿਸਟਰੇਸ਼ਨ ਕੀਤਾ ਜਾਵੇ ਤਾਂ ਜੋ ਮੈਂ ਉਹਨਾਂ ਦੀ ਰਜਿਸਟਰੇਸ਼ਨ ਦਫਤਰ ਵਿੱਚ ਸਬਮਿਟ ਕਰ ਸਕਾਂ ਅਤੇ ਮੇਰੇ ਜਿਹੜੇ ਰਿਸ਼ਤੇਦਾਰਾਂ ਦੀ ਮੌਤ ਹੋਈ ਹੈ ਮੈਨੂੰ ਉਹਨਾਂ ਦਾ ਬੇਹੱਦ ਅਫਸੋਸ ਹੈ ਉਹਨਾਂ ਦਾ ਨਾਮ ਅਜਮੇਰ ਸਿੰਘ ਹੈ ਅਤੇ ਉਹਨਾਂ ਦੀ ਮੌਤ ਅਠਾਰ੍ਹਾਂ ਤਾਰੀਖ ਗਿਆਰ੍ਹਵਾਂ ਮਹੀਨਾ ਦੋ ਹਜ਼ਾਰ ਚੋਵੀਸ ਨੂੰ ਹੋਈ ਹੈ ਸਥਾਨ ਫਾਜ਼ਿਲਕਾ ਅਤੇ ਮੈਨੂੰ ਉਹਨਾਂ ਦਾ ਮੌਤ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕੀਤਾ ਜਾਵੇ